ਠੀਕ ਹੈ ਮੈਂ ਗੁਰਚਰਨ ਸਿੰਘ ਮੈਂ ਦੋ ਵਾਰ ਅਮਰਨਾਥ ਯਾਤਰਾ ਜਾਣ ਦਾ ਮੌਕਾ ਮਿਲਿਆ ਔਰ ਮੈਨੂੰ ਆਪਣੇ ਦੋਸਤਾਂ ਦੇ ਨਾਲ ਜਿਹੜਾ ਉਹ ਸਫ਼ਰ ਕਰਨ ਦਾ ਬਹੁਤ ਆਨੰਦ ਆਇਆ ਉਹ ਸਫ਼ਰ ਦੇ ਵਿੱਚ ਪਹਿਲੀ ਵਾਰ ਜਦੋਂ ਮੈਂ ਗਿਆ ਉੱਥੇ ਰਸਤਾ ਬੰਦ ਹੋ ਗਿਆ ਅਮਰਨਾਥ ਔਰ ਉਹਦੇ ਜਿਹੜੀ ਹੈ ਵਾਪਸੀ ਥੱਲੇ ਤੋਂ ਪ੍ਰਣਾਮ ਮੱਥਾ ਟੇਕ ਕੇ ਵਾਪਿਸ ਆ ਗਏ ਦੂਸਰੀ ਵਾਰ ਫਿਰ ਗਏ ਔਰ ਫਿਰ ਜਾ ਕੇ ਦਰਸ਼ਨ ਕੀਤੇ ਔਰ ਚੜ੍ਹਾਈ ਬਹੁਤ ਜ਼ਿਆਦਾ ਸੀ ਸਖਤ ਸੀ ਅਸੀਂ ਉੱਥੋਂ ਜਿਹੜੇ ਘੋੜੇ ਲਏ ਘੋੜਿਆਂ 'ਤੇ ਸਫ਼ਰ ਕਰਕੇ ਉੱਤੇ ਜਾ ਕੇ ਦਰਸ਼ਨ ਕੀਤੇ ਉਹ ਦਰਸ਼ਨ ਕਰਨ ਤੋਂ ਬਾਅਦ ਵਾਪਿਸ ਆਏ ਫਿਰ ਮੈਂ ਪੈਦਲ ਚੱਲ ਪਿਆ ਪੈਦਲ ਚੱਲਿਆ ਉੱਨੀ ਕਿਲੋਮੀਟਰ ਦਾ ਰਸਤਾ ਸੀ ਅਤੇ ਜਦੋਂ ਪੰਜ ਛੇ ਕਿਲੋਮੀਟਰ ਬਾਕੀ ਰਹਿ ਗਿਆ ਅਤੇ ਬਾਰਿਸ਼ ਪੈਣੀ ਸ਼ੁਰੂ ਹੋ ਗਈ ਔਰ ਉਸ ਤੋਂ ਉਪਰੰਤ ਮੈਂ ਜਿਹੜਾ ਹੈ ਉਹਦਾ ਘੋੜਾ ਦੁਬਾਰੇ ਮੈਨੂੰ ਕਰਨਾ ਪਿਆ ਉਹ ਘੋੜੇ ਦੇ ਨਾਲ ਘੋੜੇ ਉੱਤੇ ਬੈਠ ਕੇ ਥੱਲੇ ਪਹੁੰਚਿਆ ਔਰ ਮੈਂ ਰਾਤ ਨੂੰ ਗਿਆਰ੍ਹਾਂ ਵਜੇ ਜਿਹੜਾ ਹੈ ਟੈਂਟ ਦੇ ਵਿੱਚ ਵਾਪਿਸ ਪਹੁੰਚਿਆ ਇਸ ਕਰਕੇ ਮੈਂ ਦੂਸ ਇਸ ਤੋਂ ਪਹਿਲਾਂ ਮੈਂ ਹੇਮਕੋਟ ਸਾਹਿਬ ਗਿਆ ਉੱਥੇ ਵੀ ਇੱਕ ਹਫ਼ਤੇ ਦਾ ਟੂਰ ਸੀ ਔਰ ਉਹ ਸਾਥੀਆਂ ਦੇ ਨਾਲ ਜਿਹੜੇ ਮੇਰੇ ਸਾਥੀ ਅੱਜ ਕਈ ਸਾਡੇ ਵਿੱਚ ਨਹੀਂ ਹੈ ਚਲੇ ਗਏ ਫਿਰ ਕੋਈ ਸਾਥੀ ਹੈਗੇ ਨੇ ਔਰ ਨੌਜਵਾਨ ਮੁੰਡੇ ਵੀ ਦੋ ਤਿੰਨ ਸਾਡੇ ਨਾਲ ਸੀ ਜਿਨ੍ਹਾਂ ਨੇ ਸਾਡੀਆਂ ਸੇਵਾਵਾਂ ਬਹੁਤ ਵਧੀਆ ਨਿਭਾਈਆਂ ਔਰ ਸਾਡੇ ਕਾਫ਼ੀ ਮਦਦ ਕੀਤੀ ਹੈ ਸਮਾਨ ਚੁੱਕਣਾ ਬੈਗ ਚੁੱਕਣੇ ਅਤੇ ਸਾਨੂੰ ਰੋਟੀ ਪਾਣੀ ਉਹਦੇ ਵਿੱਚ ਲਿਆਕੇ ਦੇ ਦੇਣਾ ਅਤੇ ਇਸ ਉਪਰੰਤ ਜਿਹੜਾ ਆ ਅਗਲਾ ਟੂਰ ਜਿਹੜਾ ਉਸਕੋ ਮੈਂ ਹੈ ਪਿਛਲੇ ਸਾਲ ਜਿਹੜਾ ਹਜ਼ੂਰ ਸਾਹਿਬ ਵੀ ਜਾ ਕੇ ਆਇਆਂ ਅਤੇ ਅੱਗੇ ਵੀ ਜਿਹੜਾ ਹੈ ਸੈਰ ਕਰਨ ਦਾ ਜਿਹੜਾ ਗੁਰੂ ਦਰਸ਼ਨਾਂ ਦਾ ਬਹੁਤ ਮਨ 'ਚ ਤਾਂਗ ਰਹਿੰਦੀ ਆ